ਅਗਸਤ ਦੋ ਹਜ਼ਾਰ ਉੱਨੀ ਵਿੱਚ ਮੈਨੂੰ ਆਈ ਆਈ ਟੀ ਵਿੱਚ ਨੌਕਰੀ ਮਿਲੀ ਮੈਨੂੰ ਲੱਗਦਾ ਹੈ ਕਿ ਮੇਰੀ ਬਹੁਤ ਵੱਡੀ ਪ੍ਰਾਪਤੀ ਹੈ ਮੇਰਾ ਸ਼ੁਰੂਆਤੀ ਦੌਰ ਕਾਫੀ ਚੁਣੌਤੀਆਂ ਭਰਿਆ ਰਿਹਾ ਮੈਂ ਅੱਠ ਘੰਟੇ ਦੀ ਡਿਊਟੀ ਮੇਰੀ ਅੱਠ ਘੰਟੇ ਦੀ ਡਿਊਟੀ ਹੋਣ 'ਤੇ ਮੈਂ ਬਾਰਾਂ ਬਾਰਾਂ ਘੰਟੇ ਕੰਮ ਵੀ ਕੀਤਾ ਸ਼ਾਮ ਨੂੰ ਘਰ ਤੋਂ ਮੈਨੂੰ ਵਾਪਸ ਵੀ ਆਉਣਾ ਪੈਂਦਾ ਸੀਗਾ ਕੰਮ ਕੰਮ ਦੌਰਾਨ ਸਾਨੂੰ ਰਾਤ ਨੂੰ ਦੋ ਦੋ ਜਾਂ ਤਿੰਨ ਵੀ ਵੱਜ ਜਾਂਦੇ ਸੀਗੇ ਮੇਰਾ ਇਹ ਟਾਇਮ ਕਾਫ਼ੀ ਚੁਣੌਤੀਆਂ ਭਰਿਆ ਸੀਗਾ ਅੱਜ ਮੈਨੂੰ ਇੱਥੇ ਚਾਰ ਸਾਲ ਹੋ ਚੁੱਕੇ ਹਨ ਅਤੇ ਮੇਰੇ ਨੀਚੇ ਇੱਕ ਸੌ ਅੱਸੀ ਬੰਦੇ ਕੰਮ ਕਰਦੇ ਹਨ ਅਤੇ ਮੇਰਾ ਸਾ ਅੱਜ ਦੀ ਡੇਟ ਵਿੱਚ ਮੇਰਾ ਸਾਰਾ ਕੰਮ ਬਹੁਤ ਅਰਾਮਦਾਇਕ ਹੋ ਚੁੱਕਾ ਹੈ ਮੇਰੇ ਸਾਰੇ ਕੰਮ ਮੇਰੇ ਫ਼ੋਨ 'ਤੇ ਹੀ ਹੋ ਰਹੇ ਆ ਮੈਨੂੰ ਇੱਧਰ ਉੱਧਰ ਭੱਜਣ ਦੀ ਜ਼ਰੂਰਤ ਨਹੀਂ ਪੈ ਰਹੀ ਮੈਨੂੰ ਲੱਗਦਾ ਹੈ ਕਿ ਇਹ ਮੇਰੀ ਬਹੁਤ ਵੱਡੀ ਪ੍ਰਾਪਤੀ ਹੈ